ਹੈਲੋ ਹਾਂਜੀ ਕੀ ਹਾਲ ਹੈ ਮੈਡਮ ਠੀਕ ਹੈ ਜੀ ਹੋਰ ਕਿਵੇਂ ਚੱਲਦੀ ਹੈ ਬੱਚਿਆਂ ਦੀ ਪੜ੍ਹਾਈ ਤੁਹਾਡੀ ਕਲਾਸ 'ਚ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਕੁਛ ਮੌਸਮ ਦਾ ਵੀ ਬਹੁਤ ਫ਼ਰਕ ਪੈ ਰਿਹਾ ਨਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਬੱਚਿਆਂ ਦਾ ਵੀ ਕੀ ਕਸੂਰ ਇਹਦੇ ਵਿੱਚ ਹਾਂ ਬਸ ਤੁਹਾਡੇ ਵਾਲਾ ਹਾਲ ਹੀ ਹੈ ਜੀ ਪੂਰੇ ਤਾਂ ਜਿਹੜੇ ਆਉਂਦੇ ਆ ਹਾਂਜੀ ਬਾਕੀ ਇਹ ਆ ਵੀ ਚਲੋ ਜਿੰਨੇ ਆਉਂਦੇ ਆ ਬਸ ਪੜ੍ਹਾਈ ਦਾ ਹਾਲ ਤਾਂ ਠੀਕ ਠਾਕ ਹੀ ਆ ਹਮ ਹਾਂਜੀ ਇਹ ਤਾਂ ਹੈ ਮੈਮ ਤੇ ਫਿਰ ਬਾਕੀ ਇਹ ਚੀਜ਼ ਹੁੰਦਾ ਵੀ ਪਿੰਡਾਂ ਦੇ ਵਿੱਚ ਥੋੜ੍ਹਾ ਮਾਹੌਲ ਵੀ ਕੁਛ ਉਸ ਤਰ੍ਹਾਂ ਦਾ ਹੁੰਦਾ ਵੀ ਮਾਂ ਬਾਪ ਦਾ ਉਨ੍ਹਾਂ ਧਿਆਨ ਨਹੀਂ ਜਾਂਦਾ ਬੱਚਿਆਂ 'ਤੇ ਉਹਨਾਂ ਦੀ ਥੋੜ੍ਹੀ ਜਿਹੀ ਕੰਮ ਧੰਦੇ 'ਚ ਉਸ ਤਰ੍ਹਾਂ ਦੀ ਹੁੰਦਾ ਉਹਨਾਂ ਦਾ ਸਿਸਟਮ

ਹਾਂਜੀ ਉਹ ਤੇ ਹੈ ਤਾਂ ਕੋਈ ਗੱਲ ਨਹੀਂ ਅਤੇ ਬਾਕੀ ਫਿਰ ਛੁੱਟੀਆਂ ਕਦੋਂ ਤੋਂ ਹੋ ਰਹੀਆਂ ਬੱਚਿਆਂ ਨੂੰ ਕੁਛ ਪਤਾ ਤੁਹਾਨੂੰ ਹਾਂਜੀ ਇਹ ਤਾਂ ਹੈ ਆਪਾਂ ਫਿਰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਨਹੀਂ ਨਾ ਕਰ ਸਕਦੇ ਸਰਕਾਰਾਂ ਨੂੰ ਚਾਹੀਦਾ ਵੀ ਫਰੀ ਕਰ ਦੇਣਾ ਕਿਉਂਕਿ ਇਹ ਚੀਜ਼ ਬੱਚਿਆਂ ਦੇ ਨਾਲ ਹਾਂ ਚਲੋ ਇਹ ਤਾਂ ਵਧੀਆ ਚਲੋ ਔਨਲਾਈਨ ਹੋ ਗਏ ਨੇ ਨਾਲ ਬੱਚੇ ਥੋੜ੍ਹਾ ਪੜ੍ਹਾਈ ਨਾਲ ਜੁੜੇ ਰਹਿੰਦੇ ਆ ਅਤੇ ਥੋੜ੍ਹਾ ਜਿਹਾ ਆਪਾਂ ਨੂੰ ਵੀ ਇਹ ਹੁੰਦਾ ਵੀ ਥੋੜ੍ਹਾ ਜਿਹਾ ਇਹ ਹੁੰਦਾ ਵੀ ਚੱਲ ਨਾਲ ਨਾਲ ਜੁੜੇ ਰਹਿਣਗੇ ਤਾਂ ਅੱਗੇ ਜਦੋਂ ਵੀ ਬੱਚੇ ਰੈਗੂਲਰ ਆਉਂਦੇ ਹੈਗੇ ਕਲਾਸਾਂ ਦੇ ਵਿੱਚ ਤਾਂ ਉਹਨਾਂ ਨੂੰ ਕਵਰ ਅਪ ਕਰਨਾ ਸੌਖਾ ਹੋ ਜਾਂਦਾ ਹਾਂਜੀ ਮੈਮ ਇਹ ਤਾਂ ਹੈ ਤੇ ਚਲੋ ਬਾਕੀ ਹਾਂਜੀ ਹਾਂਜੀ ਹਾਂਜੀ ਬਹੁਤ ਚੰਗਾ ਮਿਲਿਆ ਠੀਕ ਹੈ ਜੀ